ਹੈਲੋ ਹਾਂਜੀ ਸੁਖਮਨੀ ਜੀ ਬੋਲ ਰਹੇ ਜੀ ਜੀ ਮੈਂ ਮਨਮੀਤ ਦਾ ਫਾਦਰ ਬੋਲ ਰਿਹਾ ਆਪਣੇ ਬੱਚਿਆਂ ਨੇ ਐਤਕੀ ਟੈਂਨਥ ਪਾਸ ਆਊਟ ਕਰ ਲਈ ਹੈ ਅਤੇ ਮੈਂ ਤੁਹਾਡੀ ਸਲਾਹ ਲੈਣਾ ਚਾਹੁੰਦਾ ਸੀ ਕਿ ਹੁਣ ਇਹਨਾਂ ਨੂੰ ਕਿਹੜੇ ਸਕੂਲ ਚੰਗੇ ਸਕੂਲ 'ਚ ਪਾਇਆ ਜਾਵੇ ਜੀ ਮਨਮੀਤ ਵੀ ਮੈਡੀਕਲ ਵਾਸਤੇ ਹੀ ਕਹਿ ਰਿਹਾ ਸੀ ਤਾਂ ਹੀ ਮੈਂ ਤੁਹਾਨੂੰ ਕੋਲ ਕੀਤੀ ਹੈ ਔਰ ਆਪਣੇ ਇੱਥੇ ਤਰਨ ਤਾਰਨ ਦੇ ਵਿੱਚ ਕਿਹੜਾ ਸਕੂਲ ਵਧੀਆ ਜਿੱਥੇ ਮੈਡੀਕਲ ਦੀ ਪੜ੍ਹਾਈ ਵਧੀਆ ਕਰਾਈ ਜਾਂਦੀ ਮਾਈ ਭਾਗੋ ਦਾ ਮੇਰੇ ਦਿਮਾਗ 'ਚ ਵੀ ਆਇਆ ਸੀ ਕਿਉਂਕਿ ਉੱਥੇ ਡੋਕਟਰੀ ਦੇ ਨਾਲ ਹੋਰ ਲਿੰਕ ਜਿਹੜੇ ਸਬਜੈਕਟਸ ਵੀ ਪੜ੍ਹਾਏ ਜਾਂਦੇ ਨੇ ਨਰਸਿੰਗ ਵਗੈਰਾ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ ਨੀਟ ਦੀ ਤਿਆਰੀ ਵੀ ਕਰਵਾਈ ਜਾਂਦੀ ਏ ਮੈਂ ਵੀ ਚਾਹੁੰਦਾ ਸੀ ਕਿ ਸਾਡੇ ਬੱਚੇ ਇਹੋ ਜਿਹੇ ਸਕੂਲ 'ਚ ਪੜ੍ਹਨ ਜਿੱਥੇ ਉਹਨਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਸਿੱਖਿਆ ਉਹ ਤੋਂ ਹੀ ਮਿਲ ਜਾਵੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਪਾ ਦੇਣਾ ਚਾਹੀਦਾ ਸਕੂਲ ਹਾਂ ਇਹਨਾਂ ਦੇ ਫ਼ੀਸ ਸਟਕਚਰ ਵੀ ਬਹੁਤ ਵਧੀਆ ਨੇ ਉਹ ਸਕੂਲ ਜ਼ਿਆਦਾ ਦੂਰ ਵੀ ਨਹੀਂ ਹੈ ਮਿਲ ਕੇ ਗੱਲ ਕਰਾਂਗੇ